ਨੌਂ ਫਰਵਰੀ ਉੱਨੀ ਸੌ ਨੜ੍ਹਿਨਵੇਂ ਤੀਹ ਅਕਤੂਬਰ ਉੱਨੀ ਸੌ ਛਿਆਨਵੇਂ ਪੰਜ ਅਪ੍ਰੈਲ ਉੱਨੀ ਸੌ ਤ੍ਰੇਹਠ ਸਤਾਈ ਜਨਵਰੀ ਉੱਨੀ ਸੌ ਸਤਾਨਵੇਂ ਦੋ ਅਪ੍ਰੈਲ ਉੱਨੀ ਸੌ ਅਠਾਨਵੇਂ